ਮੈਂ ਬਹੁਤ ਸਾਰੀਆਂ ਸਬਜ਼ੀਆਂ ਅਤੇ ਪਕਵਾਨ ਬਣਾ ਸਕਦੀ ਹਾਂ ਜਿਵੇਂ ਕਿ ਹਰੀਆਂ ਸਬਜ਼ੀਆਂ ਸਿਹਤ ਲਈ ਬਹੁਤ ਲਾਭਦਾਇਕ ਹੁੰਦੀਆਂ ਹਨ ਜਿਵੇਂ ਕਿ ਗਾਜਰਾਂ ਮੂਲੀਆਂ ਅਤੇ ਪੱਤੇ ਵਾਲੀਆਂ ਸਬਜ਼ੀਆਂ ਸਿਹਤ ਲਈ ਚੰਗੀਆਂ ਹੁੰਦੀਆਂ ਹਨ ਜਿਵੇਂ ਕਿ ਪੱਤਾ ਗੋਭੀ ਸ਼ਲਗਮ ਬਰੋਕਰੀ ਆਦਿ ਕਈ ਵਾਰ ਅਸੀਂ ਗੁੜ ਵਾਲੇ ਚਾਵਲ ਜਾਂ ਪ੍ਰਸ਼ਾਦ ਵੀ ਬਣਾ ਕੇ ਖਾ ਲੈਂਦੇ ਹਾਂ ਸੇਵੀਆਂ ਆਪਣੇ ਹੱਥਾਂ ਨਾਲ ਵੱਟ ਕੇ ਸੁਕਾ ਲਈ ਦੀਆਂ ਹਨ ਫੇਰ ਉਸਨੂੰ ਸਟੋਰ ਕਰਕੇ ਰੱਖ ਲਈਦਾ ਹੈ ਫਿਰ ਜਦੋਂ ਦਿਲ ਕਰੇ ਉਬਾਲ ਕੇ ਖਾ ਲਈ ਦੀਆਂ ਹਨ ਘਰ ਵਿੱਚ ਮਹਿਮਾਨ ਆਉਣ 'ਤੇ ਅਸੀਂ ਬਹੁਤ ਵਾਰੀ ਗੁੜ ਵਾਲੇ ਚਾਵਲ ਸੇਵੀਆਂ ਬਣਾਉਂਦੇ ਹਾਂ ਮਹਿਮਾਨਾਂ ਨੂੰ ਬਹੁਤ ਚੰਗਾ ਅਤੇ ਸਵਾਦ ਆਉਂਦਾ ਹੈ ਅਸੀਂ ਬਜ਼ਾਰ ਦੀਆਂ ਚੀਜ਼ਾਂ ਜਿਵੇਂ ਕਿ ਗੁਲਾਬ ਜਾਮਣ ਰਸਗੁੱਲੇ ਬਰਫੀ ਸਮੋਸੇ ਆਦਿ ਬਹੁਤ ਘੱਟ ਖਾਂਦੇ ਹਾਂ ਕਿਉਂਕਿ ਉਹ ਸਿਹਤ ਲਈ ਇੰਨੇ ਚੰਗੇ ਨਹੀਂ ਹੁੰਦੇ ਸਾਡਾ ਪੰਜਾਬੀਆਂ ਦਾ ਖਾਸ ਕਰ ਸਾਡੇ ਪਿੰਡਾਂ ਦਾ ਖਾਣ ਖਾਣਾ ਘਰ ਦੀ ਰੋਟੀ ਸਰ੍ਹੋਂ ਦਾ ਸਾਗ ਮੱਖਣ ਘਿਓ ਅਤੇ ਘਰ ਦੀ ਚਾਟੀ ਦੀ ਲੱਸੀ ਵਲ ਲੱਸੀ ਬਹੁਤ ਸਵਾਦ ਲੱਗਦੀ ਹੈ ਇਸੇ ਨਾਲ ਸਾਡੀਆਂ ਸਿਹਤਾਂ ਚੰਗੀਆਂ ਰਹਿੰਦੀਆਂ ਹਨ ਅਤੇ ਪੰਜਾਬੀ ਜ਼ਿਆਦਾਤਰ ਬਹੁਤ ਮਿਹਨਤ ਕਰਦੇ ਹਨ